ਪੰਜਾਬ ਵਿੱਚ ਘੁੰਮਣ ਲਈ ਬਹੁਤ ਜ਼ਿਆਦਾ ਥਾਵਾਂ ਨੇ ਅਤੇ ਮਸਤੀ ਕਰਨ ਲਈ ਇੱਥੇ ਧਾਰਮਿਕ ਥਾਵਾਂ ਵੀ ਬਹੁਤ ਨੇ ਪਹਿਲਾਂ ਧਾਰਮਿਕ ਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਹਰਿਮੰਦਰ ਸਾਹਿਬ ਜਲਿਆਂਵਾਲਾ ਬਾਗ ਹੋਰ ਵੀ ਬਥੇਰੇ ਧਾਰਮਿਕ ਅਸਥਾਨ ਨੇ ਘੁੰਮਣ ਲਈ ਬਾਕੀ ਮਸਤੀ ਦੀ ਗੱਲ ਕੀਤੀ ਜਾਵੇ ਤਾਂ ਫਿਸ਼ ਪਾਰਕ ਛੋਟੇ ਮੋਟੇ ਪਾਰਕ ਸਨ ਸਿਟੀ ਵਾਈਸ ਸਿਟੀ ਹਵੇਲੀ ਪੰਜਾਬ ਹਵੇਲੀ ਆਪਣਾ ਪੰਜਾਬ ਆਪਣਾ ਪਿੰਡ ਅਤੇ ਬਾਕੀ ਜੇ ਪੜ੍ਹਾਈ ਲਿਖਾਈ ਬਾਰੇ ਗੱਲ ਕੀਤੀ ਜਾਵੇ ਤਾਂ ਗੁਜਰਾਲ ਸਾਇੰਸ ਅਮਿਊਜਮੈਂਟ ਪਾਰਕਸ ਬਹੁਤ ਕੁਝ ਨੇ ਬਾਕੀ ਜੇ ਹੋਰ ਜ਼ਿਆਦਾ ਮਸਤੀ ਜਾਏ ਫਿਲਮਾਂ ਵਗੈਰਾ ਦੀ ਗੱਲ ਕੀਤੀ ਜਾਵੇ ਤਾਂ ਮਾਲ ਮਾਲ ਆਫ ਅ੍ਰੰਮਿਤਸਰ ਏ ਜੀ ਐਮ ਮਾਲ ਨੋਵੈਲਟੀ ਮਾਲ ਬਹੁਤ ਕੁਝ ਨੇ ਮਤਲਬ ਕਿ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਵੀ ਘੁੰਮਣ ਲਈ ਬਹੁਤ ਜ਼ਿਆਦਾ ਥਾਵਾਂ ਨੇ ਪਰ ਲੋਕ ਜ਼ਿਆਦਾਤਰ ਬਾਹਰ ਜਾਣ ਨੂੰ ਹੀ ਦੇਖਦੇ ਨੇ ਪਰ ਬਾਹਰ ਜਾਣਾ ਵੀ ਜ਼ਿਆਦਾ ਪੈਸੇ ਖਰਚ ਹੁੰਦੇ ਨੇ ਕੋਈ ਫਾਇਦਾ ਨਹੀਂ ਬਾਹਰ ਜਾਣ ਦਾ ਅਤੇ ਇਸ ਤੋਂ ਚੰਗਾ ਇਹੀ ਹੈ ਕਿ ਬੰਦਾ ਪੰਜਾਬ ਵਿੱਚ ਹੀ ਥਾਵਾਂ ਲੱਭੇ ਅਤੇ ਉੱਥੇ ਹੀ ਘੁੰਮ ਲਏ ਕਿਉਂਕਿ ਬਾਹਰ ਜਾ ਕੇ ਬੰਦਾ ਇਕੱਲਾ ਹੀ ਘੁੰਮ ਸਕਦਾ ਹੈ ਬਟ ਪੰਜਾਬ ਵਿੱਚ ਰਹੇਗਾ ਤਾਂ ਇਹ ਆਪਣੇ ਪਰਿਵਾਰ ਨੂੰ ਵੀ ਨਾਲ ਘੁੰਮਾ ਸਕੇਗਾ ਅਤੇ ਵਧੀਆ ਵਧੀਆ ਯਾਦਾਂ ਬਣ ਜਾਣਗੀਆਂ ਵੈਸੇ ਅੱਜ ਕੱਲ੍ਹ ਪਠਾਨਕੋਟ ਵਿੱਚ ਵੀ ਇੱਕ ਨਵਾਂ ਡਾਊਨ ਟਾਊਨ ਖੁੱਲ੍ਹਿਆ ਨੇ ਜਿੱਥੇ ਕਿ ਖਾਣ ਦੀ ਬਹੁਤ ਜ਼ਿਆਦਾ ਥਾਵਾਂ ਨੇ ਖਾਣ ਲਈ ਵੀ ਤੁਹਾਨੂੰ ਵੈਸੇ ਹਰ ਰੋਡ 'ਚ ਹਰ ਮੁਹੱਲੇ 'ਚ ਕੋਈ ਨਾ ਕੋਈ ਥਾਂ ਲੱਭ ਹੀ ਜਾਏਗੀ ਪਰ ਵਧੀਆ ਥਾਵਾਂ ਜ਼ਿਆਦਾਤਰ ਪਠਾਨਕੋਟ ਜਾਂ ਅੰਮ੍ਰਿਤਸਰ ਵਾਲੇ ਪਾਸੇ ਹੀ ਨੇ ਚੰਡੀਗੜ੍ਹ ਚਲ ਜੋ ਚੰਡੀਗੜ੍ਹ ਘੁੰਮਣ ਲਈ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਉਹ ਪੰਜਾਬ ਵਿੱਚ ਹੀ ਆਉਂਦੇ ਨੇ ਉਹਨਾਂ ਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਹੈ ਪਰ ਹੈ ਉਹ ਪੰਜਾਬ ਵਿੱਚ ਹੀ ਹੈ ਬਾਕੀ ਵੇਖਿਆ ਜਾਵੇ ਤਾਂ ਹੋਰ ਵੀ ਬਥੇਰੀਆਂ ਥਾਵਾਂ ਨੇ ਘੁੰਮਣ ਵਾਸਤੇ ਤੁਸੀਂ ਅਗਰ ਕੁਛ ਵੀ ਘੁੰਮਣ ਵਾਸਤੇ ਥਾਵਾਂ ਲੱਭਣੀਆਂ ਤੁਸੀਂ ਗੂਗਲ ਵੀ ਕਰ ਸਕਦੇ ਹੋ ਪਰ ਬਾਕੀ ਦੇਖਿਆ ਜਾਵੇ ਤਾਂ ਹਰਿਮੰਦਰ ਸਾਹਿਬ ਜਲਿਆਂਵਾਲਾ ਬਾਗ ਇੱਕ ਵਾਰੀ ਜ਼ਰੂਰ ਜਾਓ ਅਤੇ ਧਾਰਮਿਕ ਥਾਵਾਂ ਦਾ ਮਨੋਰੰਜਨ ਉਠਾਓ